ਭਾਰਤ ਵਿੱਚ ਮੁੱਖ ਮੰਤਰੀ ਵਿੱਚ ਹਰ ਇਕ ਰਾਜ ਦੀ ਸਰਕਾਰ ਦਾ ਮੁਖੀ ਹੁੰਦਾ ਹੈ ਕਿਸੇ ਰਾਜ ਵਿੱਚ ਰਾਜ ਵਿਧਾਨ ਸਭਾ ਜਾਂ ਵਿਧਾਨ ਸਭਾ ਸਭਾ ਦੀਆਂ ਚੋਣਾਂ ਤੋਂ ਬਾਅਦ ਰਾਜ ਦਾ ਰਾਜਪਾਲ ਆਮ ਤੌਰ 'ਤੇ ਸਰਕਾਰ ਬਣਾਉਣ ਲਈ ਬਹੁਮਤ ਸੀਟਾਂ ਅਤੇ ਪਾਰਟੀ ਨੂੰ ਸੱਦਾ ਦਿੰਦਾ ਹੈ ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ ਸਹੁੰ ਚੁਕਾਉਂਦਾ ਹੈ ਜਿਸ ਦੀ ਮੰਤਰੀ ਮੰਡਲ ਸਮੂਹਿਕ ਤੌਰ 'ਤੇ ਵਿਧਾਨ ਸਭਾ ਲਈ ਜ਼ਿੰਮੇਵਾਰ ਹੁੰਦੀ ਹੈ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਕਿੰਨੀ ਵਾਰ ਵੀ ਮੁੱਖ ਮੰਤਰੀ ਬਣ ਸਕਦਾ ਹੈ ਇਸ ਦੀ ਕੋਈ ਸੀਮਾ ਨਹੀਂ ਹੁੰਦੀ ਇਸ ਮੁੱਖ ਮੰਤਰੀ ਸਰਕਾਰ ਦੀ ਮੰਤਰੀ ਮੰਡਲ ਦੀ ਅਗਵਾਈ ਕਰਦਾ ਹੈ ਅਤੇ ਉਹ ਆਪਣੇ ਕੰਮ ਨੂੰ ਵੰਡਣ ਲਈ ਇੱਕ ਉਪ ਮੁੱਖ ਮੰਤਰੀ ਦੇ ਤਾਇਨਾਤ ਕਰ ਸਕਦਾ ਹੈ ਮੁੱਖ ਮੰਤਰੀ ਆਮ ਤੌਰ 'ਤੇ ਮੁੱਖ ਸਕੱਤਰ ਦੀ ਚੋਣ ਕਰਦਾ ਹੈ ਅਤੇ ਆਪਣੇ ਰਾਜ ਦੇ ਕੈਬਿਨਟ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰਦਾ ਹੈ ਉਹ ਸਕੱਤਰ ਆਪਣੇ ਰਾਜ ਦੇ ਅਧਿਕਾਰੀਆਂ ਦੇ ਤਬਾਦਲੇ ਮੁਅੱਤਲ ਦਾ ਤਰੱਕੀ ਦੇ ਨਿਰਦੇਸ਼ ਵੀ ਦਿੰਦਾ ਹੈ ਅਤੇ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਹਨ ਉਹ ਪਾਰਲੀਆਂਮੈਂਟ ਜਾਂ ਕੋਈ ਵੀ ਵਿਧਾਨ ਸਭਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਐਕਟ ਪਾਸ ਵਗੈਰਾ ਕਰਵਾ ਦਿੰਦੇ ਹਨ ਅਤੇ ਕੋਈ ਨਵੀਂ ਮੁਕੀ ਮੁਹਿੰਮ ਜੇ ਚਾਲੀ ਕਰਨੀ ਹੋਵੇ ਉਹਨਾਂ ਨੇ ਉਹ ਵੀ ਉਹ ਕਰਾ ਦਿੰਦੇ ਹਨ ਅਤੇ ਉਹਨਾਂ ਦਾ ਇਹ ਹੀ ਕੰਮ ਹੁੰਦਾ ਹੈ ਵੀ ਸਾਰੀਆਂ ਚੀਜ਼ਾਂ ਨੂੰ ਅਕਸਰ ਨਾਲ ਲੈ ਕੇ ਚੱਲਣਾ ਹੁੰਦਾ ਹੈ ਸਾਰੀਆਂ ਚੀਜ਼ਾਂ ਦਾ ਇੱਕ ਡਾਟਾ ਤਿਆਰ ਕਰਨਾ ਹੁੰਦਾ ਹੈ ਉਹਨਾਂ ਦਾ ਇਹ ਹੀ ਕੰਮ ਹੁੰਦਾ ਹੈਗਾ ਅਤੇ ਸਾਰੇ ਸਟੇਟ ਵਿੱਚ ਜਿਵੇਂ ਆਪਣੇ ਪੰਜਾਬ 'ਚ ਹੀ ਲਾ ਲਓ ਕੋਈ ਵੀ ਆਪਣਾ ਮੁੱਖ ਮੰਤਰੀ ਹੋਵੇ ਉਸ ਨੂੰ ਹੈਨਾ ਪੂਰਾ ਸਹੀ ਤਰੀਕੇ ਨਾਲ ਉਸਨੂੰ ਚਲਾਉਣਾ ਹੁੰਦਾ ਹੈਗਾ ਇਹ ਹੀ ਕੰਮ ਹੁੰਦਾ ਬਸ